ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਉਹਨੂੰ ਮਿੱਟੀ 'ਚ ਮਲਾਉਣ ਵਾਸਤੇ ਰੂਟਾਵੀਟਰ ਜੀ ਜੇ ਤਾਂ ਤੁਸੀਂ ਬੀਜ ਬਜਾਈ ਕਰਨੀ ਕੁਛ ਹੋਰ ਬੀਜਣਾ ਫਿਰ ਆਪਣੇ ਕੋਲ ਸੁਪਰ ਸੀਡਰ ਹੈਗਾ ਜੀ ਹਾਂਜੀ ਇਹ ਤਾਂ ਨਾਲੇ ਤਾਂ ਜੀ ਪਰਾਲੀ ਨੂੰ ਉਹਨੂੰ ਨਾੜ ਨੂੰ ਅੱਗ ਨਹੀਂ ਲਾਉਣੀ ਪਊਂਗੀ ਜੀ ਅਤੇ ਇਹ ਇਹ ਵਿੱਚੇ ਤੁਹਾਡਾ ਜੋ ਵੀ ਕੁਛ ਬੀਜਣਾ ਨਾਲ ਦੀ ਨਾਲ ਬੀਜ ਹੋਜੂਗਾ ਜੀ ਜਿਵੇਂ ਨਾ ਆਪਾਂ ਵੱਢੀ ਤੁਸੀਂ ਕਣਕ ਵੱਢੀ ਹੈ ਓਹਦੇ 'ਚ ਆਪਣਾ ਪਾਣੀ ਛੱਡਦਾ ਵੱਤ ਆਏ ਤੋਂ ਤਾਂ ਤੁਹਾਨੂੰ ਅੱਗ ਨਹੀਂ ਲਾਉਣੀ ਪੈਣੀ ਬਸ ਤੁਸੀਂ ਵਿੱਚੇ ਆਪਣਾ ਜੋ ਵੀ ਬੀਜਣਾ ਮੱਕੀ ਚਰੀ ਜੋ ਵੀ ਬੀਜਣਾ ਆਪਣਾ ਵਿੱਚ ਬੀਜ ਪਾਓ ਨਾਲ ਦੀ ਨਾਲ ਉਹ ਤੁਹਾਡਾ ਖਾਦ ਦਾ ਵੀ ਕੰਮ ਕਰੂਗਾ ਜਿਹੜਾ ਨਾਲ ਹੋਊਗਾ ਜੀ ਹਾਂਜ ਹਾਂਜੀ ਹਾਂਜੀ ਸੰਦੇ ਸਾਰੇ ਹੈ ਜੀ ਹੜੰਬਾ ਹੈ ਜੀ ਸੁਪਰ ਸੀਡਰ ਹੈ ਜੀ ਰੂਟਾਵੀਟਰ ਹੈ ਜੀ ਬਾਕੀ ਹੋਰ ਬਹੁਤ ਤਰ੍ਹਾਂ ਦੇ ਸੰਦੇ ਹੈ ਜੀ ਸਭ ਸਭ ਤੋਂ ਹੈਂਜੀ ਸੁਪਰ ਸੀਡਰ ਦਾ ਜੀ ਰੇਟ ਜੀ ਇਹਦੇ ਕੰਮ ਹੈਂਜੀ ਇਹ ਇਹਦਾ ਰੇਟ ਹੈ ਜੀ ਦੋ ਲੱਖ ਰੁਪਇਆ ਜੀ ਬਾਕੀ ਸਬਸੀਡੀ ਪਾ ਕੇ ਤੁਹਾਨੂੰ ਡੇਢ ਕੁ ਲੱਖ 'ਚ ਮਿਲ ਜੂਗਾ ਜੀ ਹਾਂਜੀ ਬਾਕੀ ਹੋਰਾਂ 'ਤੇ ਵੀ ਸਬਸੀਡੀਆਂ ਸਰਕਾਰ ਬਹੁਤ ਤਰ੍ਹਾਂ ਦੀ ਦਿੰਦੀ ਹੈ ਜੀ ਤੁਹਾਡਾ ਤੁਹਾਡੋ ਕੋਲ ਕਿੰਨੇ ਕਿੱਲੇ ਹੈ ਜੀ ਅੱਛਾ ਜੀ ਟਰੈਕਟਰ ਜੀ ਟਰੈਕਟਰ ਕਿਹੜਾ ਜੀ ਉਹ ਹਿਸਾਬ ਨਾਲ ਤਿਆਰ ਕਰਕੇ ਦਊਂਗੇ ਨਾ ਜੀ ਅਸੀਂ ਹਾਂਜੀ ਟਰੈਕਟਰ ਦੀ ਹੋਰਸਪਾਵਰ ਦੇ ਹਿਸਾਬ ਨਾਲ ਤਿਆਰ ਕਰਦੇ ਹੈ ਜੀ ਹਾਂਜੀ ਹਾਂਜੀ ਹਾਂਜੀ ਜੋ ਮਰਜ਼ੀ ਫਿੱਟ ਕਰੋ ਜੀ ਕੱਲਾ ਰੂਟਾਵੀਟਰ ਚਲਾਉਣਾ ਰੂਟਾਵੀਟਰ ਚਲਾਓ ਜੀ ਉਹ ਉੱਪਰ ਵਾਲਾ ਖੋਲ੍ਹ ਦਿਓ ਡਰਿੱਲ ਖੋਲ੍ਹ ਦਿਓ ਜੀ ਹਾਂਜੀ ਹਾਂਜੀ ਇਹਦੀ ਤਾਂ ਲੈ ਜਾਂਦੇ ਹਾਂ ਆਹ ਟੂ ਇੰਨ ਵੰਨ ਹੈ ਜੀ ਹਾਂ ਠੀਕ ਹੈ ਜੀ